ਮੇਰੇ ਤਜ਼ਰਬੇ ਦੇ ਹਿਸਾਬ ਨਾਲ ਜਲੰਧਰ ਤੋਂ ਨੂਰ ਮਹਿਲ ਦਾ ਰੂਟ ਸਭ ਤੋਂ ਚੁਣੌਤੀਪੂਰਨ ਹੈ ਕਿਉਂਕਿ ਮੈਂ ਇਸ ਰੂਟ 'ਤੇ ਖੁਦ ਕਈ ਵਾਰ ਗਿਆ ਹਾਂ ਇਸ ਰੂਟ 'ਤੇ ਆਵਾਜਾਈ ਜ਼ਿਆਦਾ ਨਹੀਂ ਹੈ ਨਾ ਹੀ ਕੋਈ ਆਉਣ ਜਾਣ ਦਾ ਸਾਧਨ ਹੈ ਮੈਂ ਇਸ ਰੂਟ 'ਤੇ ਆਪਣੀ ਸਾਈਕਲ ਰਾਹੀਂ ਸਫਰ ਕੀਤਾ ਜਿਸ ਵਿੱਚ ਮੈਨੂੰ ਬਹੁਤ ਦਿੱਕਤਾਂ ਆਈਆਂ ਪਹਿਲਾਂ ਮੈਂ ਸਾਈਕਲ 'ਤੇ ਆਪਣੇ ਘਰ ਤੋਂ ਚੱਲਿਆ ਮੇਰੇ ਘਰ ਤੋਂ ਕੁਛ ਕਿਲੋਮੀਟਰ ਦਾ ਰਸਤਾ ਠੀਕ ਸੀ ਕਿਉਂਕਿ ਇਹ ਇੱਕ ਸ਼ਹਿਰ ਸੀ ਪਰ ਜਿਵੇਂ ਜਿਵੇਂ ਮੈਂ ਅੱਗੇ ਵਧਿਆ ਤਾਂ ਮੇਰੀਆਂ ਦਿੱਕਤਾਂ ਵੀ ਵਧਣ ਲੱਗ ਪਈਆਂ ਕਈ ਜਗ੍ਹਾ ਰਸਤਾ ਕੱਚਾ ਸੀ ਅਤੇ ਉਸ ਉੱਤੇ ਕਾਫੀ ਰੋੜੇ ਸੀ ਜਿਸ ਕਰਕੇ ਸਾਈਕਲ ਚਲਾਉਣ ਵਿੱਚ ਕਾਫੀ ਦਿੱਕਤ ਆ ਰਹੀ ਸੀ ਕਦੇ ਸਾਈਕਲ ਦੀ ਚੈਨ ਉਤਰ ਜਾਂਦੀ ਸੀ ਕਦੀ ਸਾਈਕਲ ਨੂੰ ਕੁਝ ਹੋ ਜਾਂਦਾ ਸੀ ਕਿਉਂਕਿ ਉਸ 'ਤੇ ਰੋੜੇ ਬਹੁਤ ਸੀ ਫਿਰ ਕਈ ਰਸਤੇ ਮਿੱਟੀ ਵਾਲੇ ਵੀ ਸੀ ਮੀਂਹ ਪੈਣ ਕਰਕੇ ਮਿੱਟੀ 'ਤੇ ਸਾਈਕਲ ਚਲਾਉਣਾ ਹੋਰ ਔਖਾ ਹੋ ਚੁੱਕਿਆ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਸਾਈਕਲ ਨੂੰ ਚਲਾਉਂਦਾ ਰਿਹਾ ਇਸ ਚੁਣੌਤੀਪੂਰਨ ਰੂਟ ਨੂੰ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਿ ਮੈਂ ਆਪਣੀ ਜਗ੍ਹਾ 'ਤੇ ਪਹੁੰਚ ਸਕਾਂ ਕੱਚੇ ਰਸਤੇ ਹੋਣ ਕਰਕੇ ਮੈਨੂੰ ਇਸ ਉੱਤੇ ਕਾਫੀ ਟਾਈਮ ਲੱਗ ਗਿਆ ਪਰ ਮੈਂ ਔਖੇ ਸੌਖੇ ਹੋ ਕੇ ਇਸ ਚੁਣੌਤੀਪੂਰਨ ਰੂਟ ਨੂੰ ਆਪਣੇ ਸਾਈਕਲ 'ਤੇ ਪੂਰਾ ਕੀਤਾ